ਪੰਜ ਅੰਕ ਜਿਹੜੇ ਦਸ ਤੋਂ ਦਸ ਲੱਖ ਦੇ ਵਿੱਚ ਆਉਂਦੇ ਹਨ ਉਹ ਹਨ ਸੌ ਦਸ ਹਜ਼ਾਰ ਲੱਖ ਇੱਕ ਲੱਖ ਪਚਾਨਵੇਂ ਹਜ਼ਾਰ ਦੋ ਲੱਖ